ਨਮਸਕਾਰ ਸਰ ਸਰ ਟ੍ਰੇਨ ਦੀ ਬੁਕਿੰਗ ਕਰਾਉਣੀ ਜੀ ਫਿਰੋਜ਼ਪੁਰ ਜਾਣਾ ਸੀਗਾ ਸਰ ਕਿੰਨੇ ਕਿੰਨੇ ਵਜ੍ਹੇ ਜਾਂਦੀਆਂ ਟ੍ਰੇਨਾਂ

ਅੱਛਾ ਜੀ ਉਦੋਂ ਬਾਅਦ ਵੀ ਹੈਗੀ ਕੋਈ ਅੱਛਾ ਜੀ ਸੱਤ ਵਜ੍ਹੇ ਤੋਂ ਬਾਅਦ ਤਾਂ ਨਹੀਂ ਜਾਂਦੀ ਕੋਈ ਲਾਸਟ ਆ ਸੱਤ ਵਜ੍ਹੇ

ਠੀਕ ਆ ਸਰ ਸਰ ਕਿੰਨਾ ਕਿਰਾਇਆ ਜੀ ਫਿਰੋਜ਼ਪੁਰ ਦਾ ਐਕਸਪ੍ਰੈਸ ਜਾਂ ਐਂਟਰਸਿਟੀ ਐਕਸਪ੍ਰੈਸ ਜਾਂ ਐਂਟਰਸਿਟੀ ਦੀ ਕਰਾਉਣੀ

ਅੱਛਾ ਜੀ ਠੀਕ ਹੈ ਜੀ ਅਤੇ ਸਰ ਕੋਈ ਦਸ ਵਜ੍ਹੇ ਜਾਂਦੀ ਨਾਈਟ ਨੂੰ

ਸਰ ਚਲੋ ਵੇਹਨੇ ਹਾਂ ਵੀ ਤੜਕੇ ਵੱਲ ਵੇਖੀਏ ਜਾਂ ਨਾਈਟ ਵਾਲੀ ਵੇਖੀਏ ਜੀ ਸਰ ਸਿੱਧੀ ਜਾਵੇਗੀ ਟ੍ਰੇਨ ਮਤਲਬ ਉਹ ਮਤਲਬ ਸਟੇਸ਼ਨ ਕਿਹੜੇ ਕਿਹੜੇ ਆਉਂਦੇ ਰਸਤੇ 'ਚ ਅੱਛਾ ਜੀ ਵੱਡਾ ਸਟੇਸ਼ਨ ਮਤਲਬ ਜਲਾਲਾਬਾਦ ਆਉਂਦਾ ਜੀ ਉਹਦੋਂ ਬਾਅਦ ਫਿਰੋਜ਼ਪੁਰ ਉਹ ਗਾਹਾਂ ਫਿਰੋਜ਼ਪੁਰ ਆ ਗਿਆ ਠੀਕ ਹੈ ਜੀ ਥੈਂਕ ਯੂ ਸਰ ਹੋਰ ਸਰ ਵੀ ਮਤਲਬ ਕਿੰਨੇ ਵਜ੍ਹੇ ਮਤਲਬ ਆ ਜਾਂਦੀ ਟ੍ਰੇਨ ਇਸੇ ਪਲਾਟਫੋਰਮ 'ਤੇ ਕਿੰਨੇ ਨੰਬਰ 'ਤੇ ਆਉਂਦੀ ਹੈ ਅੱਛਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਅਤੇ ਸਰ ਉਧਰੋਂ ਫਿਰੋਜ਼ਪੁਰ ਤੋਂ ਵਾਪਸ ਕਿੰਨੇ ਵਜ੍ਹੇ ਆਉਂਦੀ ਹੈ ਹਾਂਜੀ ਹਾਂਜੀ ਆਹੀ ਟ੍ਰੇਨ ਜੇ ਮਤਲਬ ਦਸ ਵਜ੍ਹੇ ਵਾਲੀ ਜਾਣਾ ਹੋਵੇ ਤਾਂ

ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਅਤੇ ਸਰ ਸਲੀਪਰ ਬੁਕਿੰਗ ਕਰਾ ਸਕਦੇ ਹੈ ਜੀ ਜੇ ਨਾਈਟ ਨੂੰ ਜਾਣਾ ਹੋਵੇ ਤਾਂ ਅੱਛਾ ਜੀ ਅਤੇ ਉਹਦਾ ਵੀ ਚਾਰਜ ਡਬਲ ਹੁੰਦਾ ਕੇ ਤਿਗਣਾ ਹੁੰਦਾ ਜੀ ਅੱਛਾ ਜੀ ਠੀਕ ਹੈ ਜੀ ਨਾਈਟ ਸਲੀਪਰ ਵਾਲੀ ਕਿੰਨੇ ਵਜ੍ਹੇ ਤੁਰਦੀਆਂ ਕੋਈ ਆਈਡੀਆ ਹੈਗਾ ਜੀ ਆਪਾਂ ਨੂੰ ਅੱਛਾ ਜੀ ਉਹ ਤੋਂ ਬਾਅਦ ਠੀਕ ਹੈ ਜੀ ਬਾਰ੍ਹਾਂ ਵਜ੍ਹੇ ਲਾਸਟ ਏ ਠੀਕ ਹੈ ਸਰ